ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਆ ਹਾਂਜੀ ਤੁਸੀਂ ਕਿੱਦਾਂ ਦਾ ਕਰਵਾਉਣਾ ਵੋਲਪੈਪਰ ਵੋਲਪੈਪਰ ਵਿੱਚ ਵੀ ਬਹੁਤ ਡਿਜਾਇਨ ਹੁੰਦੇ ਆ ਤੁਸੀਂ ਇੱਕ ਵਾਰੀ ਸਾਡੀ ਸ਼ੋਪ 'ਤੇ ਆ ਜਾਉ ਅਤੇ ਕਲਰ ਸਲੈਕਟ ਕਰ ਜਾਉ ਜਾਂ ਡਿਜਾਇਨ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਅਤੇ ਦੇਖ ਲਿਓ ਜਾਂ ਤੁਹਾਡੇ ਕੋਲ ਕੋਈ ਡਿਜ਼ਾਇਨ ਪਿਆ ਜਾਂ ਤੁਸੀਂ ਕਿਸੇ ਦੇ ਘਰ ਦੇਖਿਆ ਜਾਂ ਉੱਦਾਂ ਦਾ ਲਵਾਉਣਾ ਚਾਹੁੰਦੇ ਜਾਂ ਕੋਈ ਵੀ ਫੋਟੋ ਜਾਂ ਕੁਛ ਵੀ ਹੈਗਾ ਤੁਹਾਡੇ ਕੋਲ ਤਾਂ ਸਾਡੇ ਕੋਲ ਲੈ ਆਓ ਅਸੀਂ ਉੱਦਾਂ ਦੀ ਵੀ ਕੋਸ਼ਿਸ਼ ਕਰ ਦੇਵਾਂਗੇ ਕਿ ਤੁਹਾਡੇ ਉੱਦਾਂ ਦਾ ਵੋਲਪੇਪਰ ਲਗਾ ਦਿੱਤਾ ਲਗਾ ਦੀਏ ਬਾਕੀ ਜੇ ਤੁਸੀਂ ਇੱਥੇ ਆ ਕੇ ਵੇਖਣਾ ਤਾਂ ਤੁਸੀਂ ਇੱਕ ਵਾਰੀ ਸ਼ੋਪ 'ਤੇ ਆ ਜਾਉ ਅਤੇ ਜਦੋਂ ਆਉਂਗੇ ਇੱਕ ਵਾਰੀ ਕਾਲ ਕਰ ਲੈਣਾ ਸ਼ੋਪ 'ਤੇ ਆਉਣ ਤੋਂ ਪਹਿਲਾਂ ਅਤੇ ਸਲੈਕਟ ਕਰ ਜਿਓ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਵੇ ਹਾਂਜੀ ਠੀਕ ਹੈ ਅਤੇ ਆਪਣੇ ਕਿੰਨੇ ਰੂਮ ਨੇ

ਠੀਕ ਹੈ ਕਿਚਨ ਦੇ ਹਿਸਾਬ ਨਾਲ ਆਪਣਾ ਕਲਰ ਵੀ ਵੇਖ ਲਿਓ ਅਤੇ ਬੈਡਰੂਮ ਦੇ ਹਿਸਾਬ ਨਾਲ ਵੀ ਵੇਖ ਲਿਓ ਬਾਕੀ ਤੁਸੀਂ ਕਦੋਂ ਆ ਸਕਦੇ ਹੋ ਚਲੋ ਦੇਖ ਲਿਓ ਜਦੋਂ ਵੀ ਆਉਂਗੇ ਤਾਂ ਇੱਕ ਵਾਰੀ ਕੋਲ ਕਰ ਲੈਣਾ ਹਾਂਜੀ ਠੀਕ ਹੈ ਓਕੇ ਓਕੇ ਠੀਕ